ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪੰਦਰਾਂ ਦਿਨ ਪਹਿਲਾਂ ਤੁਹਾਡੇ ਕੋਲੋਂ ਇੱਕ ਸ਼ੂਜ ਮੰਗਾਏ ਸੀਗੇ ਜਿਹੜੇ ਕਿ ਮੈਨੂੰ ਹਫਤਾ ਲੇਟ ਪ੍ਰਾਪਤ ਹੋਏ ਮੈਨੂੰ ਉਹਨਾਂ ਦਾ ਬਹੁਤ ਹੀ ਘਟੀਆ ਐਕਸਪੀਰੀਅੰਸ ਹੋਇਆ ਜਿੱਦਾਂ ਕਿ ਗੱਲ ਕਰੀਏ ਜਿਹੜਾ ਤੁਹਾਡਾ ਡਿਲੀਵਰੀ ਬੋਆਏ ਆਇਆ ਸੀਗਾ ਮੇਰੇ ਕੋਲ ਉਹ ਮੇਰੇ ਘਰ ਤੱਕ ਉਹ ਬੂਟ ਡਿਲੀਵਰ ਕਰਨ ਨਹੀਂ ਆਇਆ ਉਹ ਮੇਰੇ ਤੋਂ ਟੈਕਸਟਰਾ ਚਾਰਜ ਮੰਗ ਰਿਹਾ ਸੀਗਾ ਮੇਰੇ ਘਰ ਤੱਕ ਆਉਣ ਲਈ ਅਤੇ ਮੈਂ ਉਸ ਨੂੰ ਸਾਫ ਸਾਫ ਮਨਾ ਕਰ ਦਿੱਤਾ ਅਤੇ ਬਾਅਦ ਵਿੱਚ ਮੈਨੂੰ ਉਹਦੇ ਕੋਲ ਜਾ ਕੇ ਹੀ ਮੇਰਾ ਆਪਣਾ ਔਡਰ ਜਿਹੜਾ ਮੈਂ ਬੂਟਾਂ ਦਾ ਮੰਗਵਾਇਆ ਸੀਗਾ ਉਹ ਰਿਸੀਵ ਕਰਨਾ ਪਿਆ ਜਦੋਂ ਮੈਂ ਉਹ ਔਡਰ ਰਿਸੀਵ ਕੀਤਾ ਤਾਂ ਉਹ ਮੈਨੂੰ ਲੱਗ ਰਿਹਾ ਸੀਗਾ ਜਿਵੇਂ ਉਹ ਔਡਰ ਬਹੁਤ ਪੁਰਾਣੇ ਸਮੇਂ ਦਾ ਕੀਤਾ ਹੋਇਆ ਹੁੰਦਾ ਹੈ ਅਤੇ ਉਹ ਉਹਦੀ ਪੈਕਿੰਗ ਬਿਲਕੁਲ ਫਟੀ ਹੋਈ ਸੀਗੀ ਅਤੇ ਬਹੁਤ ਗੰਦੀ ਸੀ ਅਤੇ ਜਿਸ ਨਾਲ ਮੈਨੂੰ ਲੱਗਿਆ ਮੈਂ ਤਾਂ ਫਸ ਗਿਆ ਪਰ ਜਦੋਂ ਮੈਂ ਉਸਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਜੋ ਮੈਂ ਸ਼ੂਜ ਮੰਗਾਏ ਸੀਗੇ ਉਹ ਰੰਗ ਹੀ ਨਹੀਂ ਸੀਗਾ ਅਤੇ ਉਸ ਦੀ ਕੰਪਨੀ ਵੀ ਕੋਈ ਹੋਰ ਸੀਗੀ ਅਤੇ ਉਸਦੇ ਜਿਹੜਾ ਪਤਾਵਾਂ ਸੀਗਾ ਉਹ ਵੀ ਬਹੁਤ ਹਾਰਡ ਸੀ ਅਤੇ ਉਸਦੇ ਸੋਲ ਸੀਗੇ ਉਹ ਵੀ ਬਹੁਤ ਜ਼ਿਆਦਾ ਭਾਰੀ ਸੀਗੇ ਜਿਸ ਨਾਲ ਜਿਹੜੇ ਬੂਟ ਪਾਏ ਹੋਏ ਸੀਗੇ ਪੈਰਾਂ ਵਿੱਚ ਬਹੁਤ ਜ਼ਿਆਦਾ ਭਾਰੀ ਲੱਗ ਰਹੇ ਸੀ ਅਤੇ ਇੱਦਾਂ ਹੀ ਜੇ ਉਹਨਾਂ ਦੀ ਫੀਤਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਫੀਤੇ 'ਤੇ ਮੈਂ ਉਸ ਨੂੰ ਥੋੜ੍ਹਾ ਜਿਹਾ ਜੋਰ ਨਾਲ ਖਿੱਚ ਲਿਆ ਤਾਂ ਉਹ ਅੱਗੇ ਤੋਂ ਟੁੱਟ ਗਿਆ ਮੈਨੂੰ ਤਾਂ ਲੱਗਦਾ ਮੈਂ ਤੁਹਾਡੇ ਕੋਲ ਆਪਣੇ ਸਾਰੇ ਪੈਸੇ ਖਰਾਬ ਕਰ ਦਿੱਤੇ ਨੇ ਜਾਂ ਤਾਂ ਹੁਣ ਇਸ ਨੂੰ ਜੋ ਮੈਂ ਦੇਖੇ ਸੀਗੇ ਸ਼ੂਜ ਉਹੀ ਭੇਜੋ ਨਹੀਂ ਤਾਂ ਮੇਰੇ ਪੈਸੇ ਵਾਪਸ ਕਰੋ ਧੰਨਵਾਦ